ਮੈਂ ਰਾਜਕੁਮਾਰੀ ਸਿਹਤ ਸੰਭਾਲ ਕਰਮਚਾਰੀ ਹਾਂ ਅਤੇ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹੁੰਦੀ ਹਾਂ ਕੋਵਿਡ ਨਾਈਨਟੀਨ ਵੈਕਸੀਨ ਦੀ ਬੂਸਟਰ ਖੁਰਾਕਾਂ ਦੀ ਉਪਲਬਧਤਾ ਬਾਰੇ ਕੋਵਿਡ ਕੋਵਿਡ ਸੀਲਡ ਅਤੇ ਕੋਵਿਡ ਵੈਕਸੀਨ ਦੀਆਂ ਖੁਰਾਕਾਂ ਕਿੰਨੀਆਂ ਤੁਹਾਡੇ ਕੋਲ ਉਪਲਬਧ ਹਨ ਅਤੇ ਕਿੰਨੀਆਂ ਵੰਡੀਆਂ ਗਈਆਂ ਹਨ ਉਸ ਬਾਰੇ ਸਾਰੀ ਮੈਨੂੰ ਜਾਣਕਾਰੀ ਦਿੱਤੀ ਜਾਵੇ ਕਿਨ ਕਿੰਨੀਆਂ ਤੁਹਾਨੂੰ ਪ੍ਰਾਪਤ ਹੋਈਆਂ ਸੀ ਅਤੇ ਕਿੰਨੀਆਂ ਵੰਡੀਆਂ ਗਈਆਂ ਹਨ ਅਤੇ ਉਸਦੇ ਰੇਟ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ